ਹਾਂਜੀ ਚਨਲ ਗੁਰਕਮਲ ਸਿੰਘ ਬੋਲਦੇ ਪਏ ਹੋ ਰਿਟਾਇਰਡ ਹੋ ਅੱਛਾ ਜੀ ਉਹ ਮੈਂ ਬੋਲਦਾ ਸੀਗਾ ਜੀ ਏ ਬੀ ਪੀ ਨਿਊਜ਼ ਤੋਂ ਚੜ੍ਹਦੇ ਪੰਜਾਬ ਤੋਂ ਜੀ ਹਾਂਜੀ ਉਹ ਮੈਂ ਤੁਹਾਡੇ ਉਹ ਸੁਣੇ ਸੀਗੇ ਜੀ ਕਿੱਸੇ ਫੌਜ ਟਾਈਮ ਦੇ ਤੁਹਾਡੇ ਹਾਂਜੀ ਮੈਂ ਤਾਂ ਜੀ ਉਹ ਹੋ ਗਿਆ ਮੇਰਾ ਮਨ ਮੋਹ ਲਿਆ ਤੁਹਾਡੇ ਜੀ ਉਹਨਾਂ ਕਾਰਨਾਮਿਆਂ ਨੇ ਹਾਂਜੀ ਇੱਕ ਚਾਈਨਾ ਦਾ ਵੀ ਸੁਣਿਆ ਤੁਹਾਡਾ

ਹਾਂਜੀ ਹਾਂਜੀ ਹਾਂਜੀ

ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ

ਅੱਛਾ ਜੀ ਅੱਛਾ ਜੀ ਅੱਛਾ ਜੀ

ਅੱਛਾ ਜੀ ਇੱਕ ਸਰ ਇੱਕ ਇੱਕ ਉਹ ਵੀ ਸੀਗਾ ਜੀ ਬਾਂਹ 'ਤੇ ਗੋਲੀ ਵੱਜੀ ਤੁਹਾਡੇ ਮੋਢੇ 'ਤੇ ਮੋਢੇ 'ਤੇ ਗੋਲੀ ਵੱਜੀ ਸੀ ਅੱਛਾ ਜੀ

ਹਾਂਜੀ ਹਾਂਜੀ ਅੱਛਾ ਅੱਛਾ ਜੀ ਹੈਲੋ ਹੈਲੋ ਹੈਲੋ ਅੱਛਾ ਜੀ ਚੈਨਲ ਤਾਂ ਵਧੀਆ ਚੱਲਦਾ ਜੀ ਤੁਹਾਡਾ ਪੌਡਕਾਸਟ ਕਰਨਾ ਸੀਗਾ ਮੈਂ ਕਿਹਾ ਇਹ ਥੋੜ੍ਹੀ ਗੱਲਾਂ ਬਾਤਾਂ ਕਰ ਲਈਏ ਕੋਈ ਸਾਂਝੀ ਕਰ ਲਈਏ ਹਾਂਜੀ ਮੈਂ ਕਿਹਾ ਥੋੜ੍ਹਾ ਜਿਹਾ ਉਹ ਪੌਡਕਾਸਟ ਸੌਖਾ ਹੋ ਜਾਂਦਾ ਕੋਸਚਨ ਪੁੱਛਣੇ ਹਾਂਜੀ ਅਤੇ ਤੁਸੀਂ ਇੱਕ ਉਹ ਵੀ ਕੀਤਾ ਸੀਗਾ ਆਹਾ ਬੰਬ ਤੋਂ ਬਚਾਇਆ ਸੀ ਗੱਡੀ ਨੂੰ ਅੱਛਾ ਜੀ ਅੱਛਾ ਜੀ ਉਹ ਕਿਵੇਂ ਜੀ ਹਮਲੇ 'ਤੇ ਹੀ ਅੱਛਾ ਜੀ ਅੱਛਾ ਜੀ ਸਨਮਾਨਿਤ ਸਿੱਖ ਕਿਹੜੇ ਕੀ ਕੀਤਾ ਆਪਾਂ ਇੰਡੀਆ ਦੀ ਸਰਕਾਰ ਨੇ ਅੱਛਾ ਜੀ ਤੁਸੀਂ ਗਏ ਉਹ ਤਾਂ ਅਤੇ ਸੰਤੋ ਸੰਤੁਸ਼ਟ ਸੀਗੇ ਵਾਹ ਜੀ ਵਾਹ ਦਿਲ ਖੁਸ਼ ਕਰ ਤਾ ਇਸ ਗੱਲ ਨੇ ਜੀ ਮੇਰਾ ਮੈਂ ਵਧੀਆ ਠੀਕ ਹੈ ਵਧੀਆ ਚੱਲੀ ਜਾਂਦਾ ਜੀ ਮੈਂ ਤਾਂ ਸੁਣਿਆ ਸੀਗਾ ਜਦ ਤੁਹਾਡੇ ਗੋਲੀ ਵੱਜੀ ਸੀਗੀ ਮੋਢੇ 'ਤੇ ਇੱਕ ਤੁਹਾਡੇ ਨਾਲੇ ਸਿਪਾਹੀ ਸੀਗਾ ਉਹ ਵੀ ਸ਼ਹੀਦ ਹੋ ਗਿਆ ਸੀਗਾ ਨਾ ਜੀ ਅੱਛਾ ਜੀ ਨਹੀਂ ਜੀ ਜਾਨ ਤਾਂ ਹਰੇਕ ਦੀ ਪਿਆਰੀ ਹੁੰਦੀ ਹੈ ਜੀ ਠੀਕ ਹੈ ਜੀ ਅੱਛਾ ਤੁਸੀਂ ਬਿੱਲ ਤੁਹਾਡਾ ਪੌਡਕਾਸਟ ਕਰਨਾ ਸੀਗਾ ਜੀ ਪੌਡਕਾਸਟ ਕਰਨਾ ਸੀ ਕਿੱਦਣ ਕਰੀਏ ਜੀ ਠੀਕ ਹੈ ਜੀ ਮੈਂ ਤੁਹਾਨੂੰ ਕਰਾਂਗਾ ਜੀ ਦੱਸ ਦਿਓ ਓਕੇ